ਕੁਝ ਸਭ ਤੋਂ ਆਮ ਗਲਤੀਆਂ ਹਨ ਜੋ ਸ਼ੁਰੂਆਤ ਕਰਨ ਵਾਲੇ ਵਿਅਕਤੀਆਂ ਨੂੰ ਪਤਾ ਹੋਣੀ ਚਾਹੀਦੀਆਂ ਹਨ ਪਹਿਲੀ ਗੱਲ ਉਸਦੀ ਉਮਰ ਹੋਣੀ ਚਾਹੀਦੀ ਹੈ ਅਠਾਰਾਂ ਪਲਸ ਜੇ ਉਹ ਕੋਈ ਵੀ ਸਾਧਨ ਜਾਂ ਕੋਈ ਵੀਹਕਲ ਚਲਾਉਣਾ ਚਾਹੁੰਦਾ ਹੈ ਅਤੇ ਦੂਜੀ ਗੱਲ ਉਸ ਕੋਲ ਲਸੈਂਸ ਹੋਣਾ ਚਾਹੀਦਾ ਉਸ ਚੀਜ਼ ਨੂੰ ਚਲਾਉਣ ਦਾ ਅਗਰ ਟੂ ਵੀਹਲਰ ਹੈ ਤਾਂ ਉਹਦੇ ਕੋਲ ਟੂ ਵੀਹਲਰ ਦਾ ਲਸੈਂਸ ਹੋਣਾ ਚਾਹੀਦਾ ਵੀ ਹਾਂ ਟੂ ਵੀਹਲਰ ਡਰਾਈਵ ਕਰਨ ਦੇ ਕਾਬਿਲ ਹੈ ਜੋ ਲਸੈਂਸ ਹੁੰਦਾ ਅਗਰ ਉਹ ਫੋਰ ਵੀਹਲਰ ਹੈ ਦੈਨ ਉਹਦੇ ਕੋਲ ਫੋਰ ਵੀਹਲਰ ਦਾ ਲਸੈਂਸ ਹੋਣਾ ਚਾਹੀਦਾ ਅਤੇ ਇਹ ਲਸੈਂਸ ਇਹ ਟਰੈਲ ਦੇ ਕੇ ਬਣਦਾ ਜੋ ਕਿ ਟਰੈਲ ਦੇਣ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਵੀ ਇਸ ਕਾਬਿਲ ਹੈ ਕਿ ਨਹੀਂ ਹੈ ਅਗਰ ਉਹ ਉਸ ਕਾਬਿਲ ਹੈ ਤਾਂ ਦੈਨ ਉਹ ਟਰੈਲ ਦੇ ਵਿੱਚ ਪਾਸ ਹੁੰਦਾ ਅਤੇ ਉਹਨੂੰ ਲਾਇਸੈਂਸ ਮਿਲ ਜਾਂਦਾ ਜਿਸ ਵਿੱਚ ਉਹਨੂੰ ਅੱਗੇ ਜਾ ਕੇ ਕੋਈ ਦਿੱਕਤ ਨਹੀਂ ਆਉਂਦੀ ਵੀ ਹਾਂ ਅੱਗੇ ਕੋਈ ਉਹਨੂੰ ਰੋਕ ਟੋਕ ਜਾਂ ਕੋਈ ਵੀ ਕੁਛ ਵੀ ਪੁਲਿਸ ਵਿਅਕਤੀ ਅਗਰ ਰੋਕਦਾ ਤਾਂ ਉਹਦੇ ਕੋਲ ਲਾਇਸੈਂਸ ਹੈਗਾ ਵੀ ਉਹ ਉਸਨੂੰ ਚਲਾ ਸਕਦਾ ਟਰੈਵਲ ਕਰ ਸਕਦਾ ਉਸਦੇ ਉੱਪਰ ਅਗਰ ਬਿਨਾਂ ਲਾਇਸੈਂਸ ਤੋਂ ਚੱਲਦੇ ਹਾਂ ਤਾਂ ਅੰਡਰ ਏਜ ਦੀ ਇਸ਼ੂ ਜੋ ਕਿ ਬਣਦੀ ਆ ਅਗਰ ਤੁਸੀਂ ਅਠਾਰਾਂ ਸਾਲ ਤੋਂ ਥੱਲੇ ਹੋ ਤਾਂ ਤੁਸੀਂ ਉਸਦੇ ਕਾਬਿਲ ਨਹੀਂ ਹੋ ਤਾਂ ਅੱਜ ਕੱਲ੍ਹ ਜੋ ਹੈ ਜਵਾਕ ਜੋ ਵੀ ਬੱਚੇ ਇਹ ਗਲਤੀਆਂ ਬਹੁਤ ਕਰਦੇ ਹਨ ਬਿਨਾਂ ਲਾਇਸੈਂਸ ਤੋਂ ਡਰਾਈਵ ਡਰਾਈਵਰ ਡਰਾਈਵ ਕਰਦੇ ਹਨ ਅਤੇ ਉਹਨਾਂ ਦੀ ਉਮਰ ਨਹੀਂ ਹੁੰਦੀ ਅਤੇ ਮੈਂ ਚਾਹੁੰਦਾ ਵੀ ਉਹਨਾਂ ਦੀ ਉਮਰ ਹੋਵੇ ਅਤੇ ਡਰਾਈਵ ਲਾਇਸੈਂਸ ਹੋਵੇ ਅਤੇ ਦੈਨ ਡਰਾਈਵ ਕਰਨ ਜਿਹਦੇ ਵਿੱਚ ਉਹਨਾਂ ਨੂੰ ਵੀ ਖ਼ਤਰਾ ਨਹੀਂ ਅਤੇ ਪੁਲਿਸ ਵਾਲਿਆਂ ਨੂੰ ਵੀ ਕੋਈ ਉਹ ਨਹੀਂ ਹੋਊਗਾ ਹਾਂ ਵੀ ਅੰਡਰ ਏਜ ਆ ਜਾਂ ਕੁਛ ਵੀ ਦੈਨ ਉਹਨਾਂ ਕੋਲ ਪਰਮਿਟ ਹੈ ਲਾਇਸੈਂਸ ਹੈ ਤਾਂ ਇਸ ਨੂੰ ਚਲਾ ਸਕਦੇ ਹਨ ਅਤੇ ਆਪਣਾ ਹੋਰ ਆਪਣੇ ਕਾਗਜ਼ ਪੱਤਰ ਜੋ ਵੀ ਗੱਡੀ ਦੇ ਹੁੰਦੇ ਹਨ ਉਹਨੂੰ ਪੂਰੇ ਰੱਖਣ ਸਹੀ ਟੈਮ 'ਤੇ ਜੋ ਇਨਸ਼ੋਰੈਂਸ ਵਗੈਰਾ ਜੋ ਵੀ ਹੁੰਦੀ ਹੈ ਕਰਵਾਉਂਦੇ ਰਹਿਣ ਅਤੇ ਆਪਣਾ ਪ੍ਰੋਪਰ ਜੋ ਵੀ ਹੁੰਦੇ ਆ ਆਪਣੇ ਡੋਕੂਮੈਂਟ ਵਗੈਰਾ ਨਾਲ ਰੱਖਣ ਵੀ ਜਿੱਥੇ ਵੀ ਕੋਈ ਰੋਕ ਲਵੇ ਤਾਂ ਤੁਸੀਂ ਦੈਨ ਡੋਕੂਮੈਂਟ ਵਗੈਰਾ ਆਪਣੇ ਸ਼ੋਅ ਕਰ ਸਕੋ